ਭਾਅ ਜੀ ਇਸ ਤਰ੍ਹਾਂ ਕਿ ਮੈਂ ਇੱਥੇ ਛੇਹਰਟਾ ਸਾਹਿਬ ਪੁਰਾਣੀ ਚੁੰਗੀ ਕੋਲ ਆ ਆਇਆ ਸੀ ਯਾਤਰਾ 'ਤੇ ਮੈਂ ਆਇਆ ਸੀ ਅਤੇ ਇੱਥੇ ਮੈਂ ਥੋੜ੍ਹਾ ਫਸ ਗਿਆ ਕੁਛ ਮੌਸਮ ਦੇ ਹਾਲਾਤ ਐਸੇ ਜੇ ਹੋ ਗਏ ਬਾਰਿਸ਼ ਬੜੀ ਹੋਈ ਆ ਅਤੇ ਮੀ ਹਨੇਰੀ ਏ ਬੜੀ ਚੱਲ ਰਹੀ ਹੈ ਔਰ ਮੈਨੂੰ ਇੱਥੇ ਕੁਛ ਫੈਸਿਲਿਟੀ ਅਵੇਲੇਬਲ ਨਹੀਂ ਹੋ ਰਹੀ ਮੈਂ ਆਇਆ ਸੀਗਾ ਅਤੇ ਮੈਂ ਹੁਣ ਇਸ ਵਕਤ ਮੈਨੂੰ ਭੁੱਖ ਬਹੁਤ ਲੱਗੀ ਆ ਮੈਨੂੰ ਥੋੜ੍ਹਾ ਭੋਜਨ ਦੀ ਵਿਵਸਥਾ ਚਾਹੀਦੀ ਸੀ ਮੈਨੂੰ ਆਸ ਪਾਸ ਕੋਈ ਨੇੜੇ ਤੇੜੇ ਤਾਂ ਕੁਛ ਨਜਰ ਨਹੀਂ ਆਉਂਦਾ ਕੀ ਤੁਹਾਡਾ ਹੁਣ ਮੈਨੂੰ ਪਤਾ ਕਿ ਤੁਹਾਡਾ ਬੜੀ ਦੂਰ ਹੈ ਰੈਸਟੋਰੈਂਟ ਅਤੇ ਤੁਸੀਂ ਇਸ ਮੁਸ਼ਕਲ ਸਥਿਤੀ ਵਿੱਚ ਮੈਨੂੰ ਤੁਸੀਂ ਭੋਜਨ ਪ੍ਰੋਵਾਈਡ ਕਰਵਾ ਸਕਦੇ ਹੋ ਪਲੀਜ਼ ਮੈਨੂੰ ਜ਼ਰਾ ਇਹ ਗਾਈਡ ਕਰੋ ਕਿ ਹਾਂ ਇਸ ਤਰ੍ਹਾਂ ਵੇ ਕਿ ਜਿਹੜਾ ਭੋਜਨ ਲੈ ਕੇ ਆਏਗਾ ਮੈਂ ਉਸਦੇ ਵਾਸਤੇ ਉਹਨੂੰ ਐਕਸਟਰਾ ਕੁਛ ਪੇਮੈਂਟ ਵੀ ਦੇ ਸਕਦਾ ਵੀ ਜਿਹੜਾ ਐਨਾ ਤੰਗੀ ਵਿੱਚ ਆਏਗਾ ਅਤੇ ਅੱਛਾ ਕਰਵਾ ਸਕਦੇ ਹੋ ਤਾਂ ਹਾਂ ਮਤਲਬ ਇਹ ਸ਼ੋਅਰ ਕਰ ਦਿਉ ਪਰ ਮਤਲਬ ਕਿ ਨਾ ਇਸ ਤਰ੍ਹਾਂ ਨਾ ਹੋਵੇ ਕਿਤੇ ਮੈਂ ਭੁੱਖਾ ਇੱਥੇ ਬੈਠਾ ਉਡੀਕਦਾ ਰਹਾਂ ਇਨਸ਼ੋਰਲੀ ਤੁਸੀਂ ਮੇਰਾ ਹੈਲਪ ਪਲੀਸ ਕਰੋ ਮੈਂ ਪੇਮੈਂਟ ਕਰ ਦੇਵਾਂਗਾ ਅੱਛਾ ਠੀਕ ਹੈ ਹਾਂ ਤਾਂ ਫਿਰ ਤੁਸੀਂ ਮੇਰਾ ਔਡਰ ਨੋਟ ਕਰ ਲਉ ਦੋ ਫੁਲਕੇ ਕੋਈ ਸਾਦੀ ਦਾਲ ਹੋ ਜਾਵੇ ਜਾਂ ਸਬਜ਼ੀ ਨਾਲ ਅਤੇ ਨਾਲ ਕੋਈ ਡਰਿੰਕ ਥੋੜ੍ਹਾ ਬਹੁਤ ਜਿਸ ਤਰ੍ਹਾਂ ਮਤਲਬ ਲਿਕੁਅਡ ਜੇ ਕੋਈ ਜੂਸ ਵਗੈਰਾ ਦਾ ਹੋ ਸਕਦਾ ਤਾਂ ਉਹ ਦੇ ਦਿਉ ਥੋੜ੍ਹਾ ਦਹੀਂ ਦੇ ਦਿਉ ਭਿਜਵਾ ਦਿਉ ਬਾਕੀ ਜੇ ਆਚਾਰ ਵਗੈਰਾ ਤਾਂ ਹੋਰ ਵਧੀਆ ਲੇਕਿਨ ਮੈਨੂੰ ਐਟਲੀਸਟ ਜਿਹੜੀ ਹੈ ਨਾ ਦੋ ਫੁਲਕੇ ਦਾਲ ਸਬਜ਼ੀ ਵਗੈਰਾ ਦਾ ਅਰੇਂਜਮੈਂਟ ਚਾਹੀਦਾ ਵੈ ਠੀਕ ਹੈ ਜੀ ਬਹੁਤ ਮਿਹਰਬਾਨੀ ਕਿੰਨੀ ਦੇਰ 'ਚ ਆ ਜਾਵੇਗਾ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ